ਪੇਂਡੂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦਾ ਕੋਈ ਪਤਾ ਨਹੀਂ ਹੈ ਨਾ ਹੀ ਉਹਨਾਂ ਕੋਲ ਪੈਸਾ ਹੈ ਕੋਈ ਅਦਾਲਤ ਵਿੱਚ ਕੇਸ ਕਰਨ ਲਈ ਅਤੇ ਬਾਕੀ ਪੁਲਿਸ ਕੋਲ ਜਾ ਕੇ ਵੀ ਕੋਈ ਇਨਸਾਫ਼ ਨਹੀਂ ਮਿਲਦਾ ਪੈਸੇ ਦੇ ਬਗੈਰ ਅਤੇ ਪੈ ਪੇਂਡੂ ਲੋਕ ਇੱਧਰ ਉੱਧਰ ਘੁੰਮ ਕੇ ਅਤੇ ਜੇ ਕੋਰਟਾਂ ਵਿੱਚ ਜਾਂਦੇ ਆ ਤਾਂ ਵਕੀਲ ਪੈਸੇ ਬਹੁਤ ਲੈਂਦੇ ਆ ਅਤੇ ਅਦਾਲਤਾਂ ਵਿੱਚ ਟੈਮ ਬਹੁਤ ਜ਼ਿਆਦਾ ਬਰਬਾਦ ਹੁੰਦਾ ਹੈ ਸਮੇਂ ਸਿਰ ਇਨਸਾਫ਼ ਨਹੀਂ ਮਿਲਦਾ ਅਤੇ ਘੁੰਮਣ ਘੇਰੀ ਵਿੱਚ ਏ ਫ਼ਸੇ ਰਹਿੰਦਾ ਹੈ ਪੇਂਡੂ ਲੋਕ